ਹੈਲੋ ਮੈਂ ਹਰਪ੍ਰੀਤ ਕੌਰ ਬੋਲ ਰਹੀ ਹਾਂ ਜੀ ਮੈਂ ਜੇ ਪੀ ਨਗਰ ਦਸ ਸੌ ਅੱਸੀ ਫਲੈਟ ਤੋਂ ਬੋਲ ਰਹੀ ਸੀ ਜੀ ਸਰ ਮੈਨੂੰ ਤੁਹਾਡਾ ਇਹ ਨੰਬਰ ਤੁਹਾਡੇ ਕਸਟਮਰ ਕੇਅਰ ਵਾਲਿਆਂ ਨੇ ਦਿੱਤਾ ਹੈ ਮੈਂ ਮੇਰੀ ਪ੍ਰੋਬਲਮ ਇਹ ਹੈ ਕਿ ਮੈਂ ਆਪਣੇ ਘਰ ਦਾ ਬਜਟ ਤਿਆਰ ਕਰ ਰਹੀ ਸੀ ਤਾਂ ਮੈਨੂੰ ਪਿਛਲੇ ਛੇ ਮਹੀਨਿਆਂ ਦੇ ਬਿਜਲੀ ਦੇ ਬਿੱਲਾਂ ਦੇ ਭੁ ਜੋ ਮੈਂ ਭੁਗਤਾਨ ਕੀਤੇ ਹਨ ਉਹਦੇ ਵਿਸਤ੍ਰਿਤ ਵੇਰਵਾ ਚਾਹੀਦਾ ਸੀ ਸਰ ਮੈਨੂੰ ਤੁਹਾਡਾ ਨੰਬਰ ਦਿੱਤਾ ਗਿਆ ਹੈ ਤਾਂ ਜੋ ਮੈਨੂੰ ਉਨ੍ਹਾਂ ਦੱਸਿਆ ਕਿ ਤੁਹਾਡੇ ਇਸ ਵਿਭਾਗ ਤੋਂ ਤੁਹਾਨੂੰ ਇਹ ਇਨਫੋਰਮੇਸ਼ਨ ਮਿਲੇਗੀ ਤਦ ਮੈਂ ਤੁਹਾਨੂੰ ਕੌਲ ਕਰ ਰਹੀ ਹਾਂ ਸਰ ਰ ਮੈਂ ਇਹ ਪਿਛਲੇ ਜਿਹੜੇ ਛੇ ਮਹੀਨਿਆਂ ਦੇ ਬਿੱਲ ਹਨ ਆਪਣੀ ਔਨਲਾਈਨ ਪੇਮੈਂਟ ਕੀਤੀ ਇਹ ਬੱਟ ਅ ਉਨ੍ਹਾਂ ਦਾ ਰਿਕੋਡ ਮੈਂ ਤੁਹਾਨੂੰ ਤੁਹਾਡੇ ਮੋਬਾਈਲ ਨੰਬਰ ਅਗਰ ਤੁਸੀਂ ਦੇ ਸਕਦੇ ਹੋ ਤਾਂ ਮੈਂ ਉਨ੍ਹਾਂ 'ਤੇ ਭੇਜ ਸਕਦੀ ਹਾਂ ਸਰ ਮੈਨੂੰ ਇਹ ਪੂਰੀ ਜਾਣਕਾਰੀ ਚਾਹੀਦੀ ਹੈ ਕਿ ਇਨ੍ਹਾਂ ਬਿਜਲੀ ਬਿੱਲ ਇਹ ਕਿੰਨਾ ਕਿੰਨੇ ਕਿੰਨੇ ਯੂਨਿਟ ਇਸ ਬਿਜਲੀ ਦੇ ਬਿੱਲ ਦੇ ਉੱਤੇ ਸਨ ਅਤੇ ਕਿੰਨਾ ਕਿੰਨੀ ਪੇਮੈਂਟ ਇਹ ਆਈ ਹੈ ਕਿਰਪਾ ਕਰਕੇ ਮੈਨੂੰ ਇਹ ਸਾਰੀ ਜਾਣਕਾਰੀ ਤੁਸੀਂ ਮੇਰੇ ਫੋਨ ਮੋਬਾਈਲ ਨੰਬਰ 'ਤੇ ਵਟਸਐਪ ਵੀ ਕਰ ਸਕਦੇ ਹੋ ਜਾਂ ਮੇਰੇ ਮੇਲ ਆਈ ਡੀ 'ਤੇ ਮੈਂ ਜੋ ਤੁਹਾਨੂੰ ਦੇਣਾ ਚਾਹੁੰਦੀ ਹਾਂ ਬੇਦੀ ਅੰਡਰਸਕੋਰ ਮਹਿਤਾ ਐਟ ਜਾਹੂ ਡੋਟ ਕੋਮ 'ਤੇ ਵੀ ਮੈਨੂੰ ਇਹ ਭੇਜ ਸਕਦੇ ਹੋ ਅਗ ਜਿੱਦਾਂ ਦਾ ਤੁਹਾਨੂੰ ਸੁਭਾਵਿਕ ਲੱਗਦਾ ਹੈ ਸਰ ਅਗਰ ਇਸ ਤੋਂ ਇਲਾਵਾ ਤੁਹਾਨੂੰ ਮੇਰੇ ਤੋਂ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਸਰ ਪਲੀਸ ਉਹ ਵੀ ਤੁਸੀਂ ਮੇਰੇ ਤੋਂ ਮੰਗ ਸਕਦੇ ਹੋ ਥੈਂਕ ਯੂ ਤੁਆਡਾ ਬਹੁਤ ਧੰਨਵਾਦ ਹੋਵੇਗਾ ਸਰ